ਸਕੂਲਾਂ ਵਿੱਚ ਅਧਿਆਪਕ ਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਜਿਵੇਂ ਕਿ ਬਲੈਕ ਬੋਰਡ ਬੁੱਕਸ ਜਿਹੜੀਆਂ ਕਿਤਾਬਾਂ ਵਾ ਜੇ ਬੱਚਿਆਂ ਨੂੰ ਪੁਰ ਮਿਲਣਗੀਆਂ ਨਹੀਂ ਤਾਂ ਬੱਚੇ ਪੜ੍ਹਨਗੇ ਕਿਸ ਤਰ੍ਹਾਂ ਹੁਣ ਦੇਖੋਗੇ ਜੇ ਟੀਚਰ ਜਿਹੜਾ ਪੜ੍ਹਾ ਰਿਹਾ ਹੈ ਉਹਨੇ ਕੀ ਆ ਬੱਚੇ ਨੂੰ ਕੁਛ ਸਮਝਾਉਣਾ ਤਾਂ ਬੱਚੇ ਤਾਂ ਹੀ ਸਮਝ ਸਕਣਗੇ ਜੇ ਉਹਨਾਂ ਕੋਲ ਕਿਤਾਬਾਂ ਹੋਣਗੀਆਂ ਹੁਣ ਸਰਕਾਰੀ ਸਕੂਲਾਂ ਦੀ ਗੱਲ ਲੈ ਲਓ ਕਿ ਉੱਥੇ ਕੀ ਆ ਬਲੈਕ ਬੋਰਡ ਹੁੰਦੇ ਨੇ ਅਤੇ ਜਿਹੜੀਆਂ ਬੁੱਕਸ ਨਹੀਂ ਹੁੰਦੀਆਂ ਹੁਣ ਜੇ ਹਰ ਇੱਕ ਚੀਜ਼ ਜਿਹੜੀ ਆ ਹੁਣ ਬਲੈਕ ਬੋਰਡ 'ਤੇ ਐਕਸਪਲੇਨ ਤਾਂ ਨਹੀਂ ਕਰ ਸਕਦੇ ਨਾ ਇਸ ਕਰਕੇ ਕੀ ਆ ਬੁੱਕਸਾਂ ਜਿਹੜੀਆਂ ਹੋਣੀਆਂ ਬੱਚਿਆਂ ਕੋਲ ਉਹ ਜ਼ਰੂਰੀ ਨੇ ਅਤੇ ਇਹਦੇ ਕਾਰਨ ਜੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬੁੱਕਸ ਜਿਹੜੀਆਂ ਨਹੀਂ ਹੋਣਗੀਆਂ ਉਹਨਾਂ ਤੋਂ ਅਤੇ ਉਹਦੇ ਨਾਲ ਕੀ ਆ ਉਹਨਾਂ ਦੀ ਜਿਹੜੀ ਆ ਨੌਲੇਜ ਦੇ ਵਿੱਚ ਇਫੈਕਟ ਪਵੇਗਾ ਉਹਨਾਂ ਨੂੰ ਜਾਣਕਾਰੀ ਜਿਹੜੀ ਉਹ ਘੱਟ ਮਿਲੇਗੀ ਇਸ ਤੋਂ ਇਲਾਵਾ ਕੀ ਆ ਬੱਚਿਆਂ ਦੀ ਜਿਹੜੀ ਯੂਨੀਫੋਰਮ ਆ ਹੁਣ ਸਰ ਕਈ ਵਾਰ ਗੋਵਰਮੈਂਟ ਵੱਲੋਂ ਜਿਹੜੀ ਸਪਲਾਈ ਕੀਤੀ ਜਾਂਦੀ ਬੱਚਿਆਂ ਨੂੰ ਫਰੀ ਔਫ ਕੋਸਟ ਮਤਲਬ ਕਿ ਫਰੀ ਜਿਹੜੀ ਵਰਦੀ ਦਿੱਤੀ ਜਾਂਦੀ ਆ ਕਈਆਂ ਨੂੰ ਉਹ ਮਿਲਦੀ ਵੀ ਨਹੀਂ ਆ ਅਤੇ ਇਹਦੇ ਨਾਲ ਕੀ ਆ ਬੱਚੇ ਜ਼ਿਆਦਾ ਤੋਂ ਜ਼ਿਆਦਾ ਗੈਰ ਹਾਜ਼ਰ ਰਹਿੰਦੇ ਆ ਜਾਂ ਮੰਨ ਲਓ ਸਰਦੀਆਂ ਦਾ ਮੌਸਮ ਆ ਉਹਨਾਂ ਨੂੰ ਯੂਨੀਫੋਰਮ ਨਹੀਂ ਮਿਲੀ ਹੋਵੇਗੀ ਕਿ ਕੋਈ ਸਵੈਟਰ ਨਹੀਂ ਮਿਲਿਆ ਹੋਵੇਗਾ ਤਾਂ ਉਹ ਕੀ ਕਈ ਜਿਹੜੇ ਆਰਥਿਕ ਪੱਖ ਤੋਂ ਜਿਹੜੇ ਘਰ ਦੇ ਆ ਉਹ ਉਹਨਾਂ ਨੂੰ ਬੱਚਿਆਂ ਨੂੰ ਜਿਹੜੀ ਆ ਵਰਦੀ ਨਹੀਂ ਲੈ ਕੇ ਦੇ ਸਕਦੇ ਤਾਂ ਉਹ ਕੀ ਆ ਬੱਚਿਆਂ ਨੂੰ ਜਿਹੜੀ ਛੁੱਟੀ ਕਰਵਾ ਲੈਂਦੇ ਨੇ ਉਹਦੇ ਨਾਲ ਕੀ ਆ ਗੈਰ ਹਾਜ਼ਰੀ ਜਿਹੜੀ ਉਹ ਵੱਧ ਜਾਂਦੀ ਤਾਂ ਬੱਚਿਆਂ ਵਿੱਚ ਅਤੇ ਟੀਚਰ ਜਿਹੜੇ ਆ ਜੋ ਵੀ ਉਹਨਾਂ ਨੇ ਟੋਪਿਕ ਜਿਹੜਾ ਕਰਵਾਉਣਾ ਹੁੰਦਾ ਆ ਉਹ ਉਹਨਾਂ ਬੱਚਿਆਂ ਦਾ ਜਿਹੜਾ ਵਾ ਮਿਸ ਹੋ ਜਾਂਦਾ ਵਾ ਜਿਹਦੇ ਕਾਰਨ ਕੀ ਆ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਅਧੂਰੀ ਰਹਿ ਜਾਂਦੀ ਆ ਅਤੇ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਵਾ ਕੀ ਆ ਨੁਕਸਾਨ ਕਰਦੀ ਆ